ਜੇ ਗੱਲ ਕਰੀਏ ਸਿਹਤ ਸੰਭਾਲ ਦੀ ਖੇਤਰ ਦੀ ਤਾਂ ਇਹ ਭ੍ਰਿਸ਼ਟਾਚਾਰ ਤੋਂ ਵਗੈਰ ਇਹ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਇੱਥੇ ਛੋਟੇ ਡਾਕਟਰ ਤੋਂ ਲੈ ਕੇ ਵੱਡੇ ਵੱਡੇ ਹੋਸਪਿਟਲਾਂ ਤੱਕ ਰਿਸ਼ਵਤ ਜਿਹੜੀ ਆ ਭ੍ਰਿਸ਼ਟਾਚਾਰ ਇਹ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਜੇ ਸਰਕਾਰੀ ਹੋਸਪਿਟਲ ਦੇ ਵਿੱਚ ਜਾਈਏ ਤਾਂ ਪਹਿਲੀ ਗੱਲ ਡਾਕਟਰ ਨਹੀਂ ਮਿਲਦਾ ਜੇ ਡਾਕਟਰ ਮਿਲ ਪਵੇ ਤਾਂ ਉਹ ਦਵਾਈ ਬਾਹਰ ਦੀ ਲਿਖ ਦਿੰਦਾ ਹੋਸਪਿਟਲ ਦੇ ਅੰਦਰੋਂ ਕੋਈ ਦਵਾਈ ਨਹੀਂ ਦਿੰਦਾ ਉੱਥੇ ਲੁੱਟਿਆ ਜਾਂਦਾ ਹੈ ਉਹ ਦਵਾਈਆਂ ਬਾਹਰ ਵੇਚ ਦਿੰਦਾ ਹੈ ਜੇ ਪ੍ਰਾਈਵੇਟ ਹੋਸਪਿਟਲ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਹੀ ਹਾਲ ਹੈ ਉੱਥੇ ਜਿਸ ਤਰ੍ਹਾਂ ਇੱਕ ਸਰਕਾਰ ਵੱਲੋਂ ਇੱਕ ਸਕੀਮ ਅਨਾਊਂਸ ਕੀਤੀ ਹੋਈ ਹੈ ਆਯੁਸ਼ਮਾਨ ਕਾਰਡ ਦੀ ਆਯੁਸ਼ਮਾਨ ਕਾਰਡ ਸਾਰੇ ਹੋਸਪਿਟਲਾਂ ਵਿੱਚ ਨਹੀਂ ਚੱਲਦਾ ਕੁੱਝ ਕੁ ਹੋਸਪਿਟਲਾਂ ਵਿੱਚ ਚੱਲਦਾ ਹੈ ਉਹਦਾ ਲਾਇਸੈਂਸ ਲੈਣ ਵਾਸਤੇ ਪਹਿਲਾਂ ਹੋਸਪਿਟਲ ਵਾਲੇ ਪੈਸਾ ਭਰਦੇ ਆ ਕਿ ਸਾਡੇ ਕੋਲ ਇਹਦਾ ਲਾਇਸੈਂਸ ਆ ਜਾਵੇ ਜਦੋਂ ਉਹਨਾਂ ਕੋਲ ਲਾਇਸੈਂਸ ਜਾਂਦਾ ਹੈ ਕਾਰਡ ਚੱਲਣ ਲੱਗਦਾ ਹੈ ਤਾਂ ਫਿਰ ਉਹ ਸਰਕਾਰ ਨੂੰ ਰੱਜ ਕੇ ਲੁੱਟਦੇ ਹਨ ਆਪਣਾ ਪੈਸਾ ਪੂਰਾ ਕਰਦੇ ਹਨ ਮੈਨੂੰ ਜਦੋਂ ਜ਼ਰੂਰਤ ਪਈ ਆਯੁਸ਼ਮਾਨ ਕਾਰਡ ਚਲਾਉਣ ਦੀ ਤਾਂ ਮੈਨੂੰ ਹੱਥੀਂ ਪੈਸੇ ਦੇ ਕੇ ਫਿਰ ਆਯੁਸ਼ਮਾਨ ਕਾਰਡ ਜਿਹੜਾ ਉਹ ਚਲਾਇਆ ਗਿਆ ਤਾਂ ਫਿਰ ਮੈਨੂੰ ਉਸਦਾ ਫ਼ਾਇਦਾ ਹੋਇਆ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ